ਪੰਜਾਬ ਵਿੱਚ ਲੋਕ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਮੇਲੇ ਲਗਾ ਕੇ ਹੀ ਮਨਾਉਂਦੇ ਹਨ ਜਿਵੇਂ ਵਿਸਾਖੀ ਦਾ ਮੇਲਾ ਲੱਗਦਾ ਹੈ ਦੁਸਹਿਰੇ 'ਤੇ ਰਾਮ ਲੀਲਾ ਦਿਖਾਈ ਜਾਂਦੀ ਹੈ ਅਤੇ ਤੀਆਂ ਦਾ ਮੇਲਾ ਲੱਗਦਾ ਹੈ ਸਾਵਣ ਦੇ ਮਹੀਨੇ ਵਿੱਚ ਜਿਵੇਂ ਜਿਹਦੇ ਵਿੱਚ ਕੁੜੀਆਂ ਕੁਆਰੀ ਕੁੜੀਆਂ ਅਤੇ ਬਹੂਆਂ ਪੀਂਘ ਪਾ ਕੇ ਪੰਜਾਬੀ ਸੂਟ ਪਰਾਂਦਾ ਪਾ ਕੇ ਤਿਆਰ ਹੁੰਦੀਆਂ ਹਨ ਇਸ ਰਾਹੀਂ ਆਪਣੇ ਸੱਭਿਆਚਾਰ ਨੂੰ ਦਰਸਾਉਂਦੀਆਂ ਹਨ